ਸਾਡੇ ਖੇ ਖੇਤਰ ਵਿੱਚ ਚਾਵਲ ਗੰਨਾ ਕਣਕ ਕਪਾਹ ਦਾਲਾਂ ਆਦਿ ਬੀਜੀਆਂ ਜਾਂਦੀਆਂ ਹਨ ਅਤੇ ਚਾਵਲ ਤੋਂ ਮਿੱਠੇ ਚੁਆਵਲ ਵੀ ਬਣਾਏ ਜਾਂਦੇ ਹਨ ਅਤੇ ਨਮਕੀਨ ਚਾਵਲ ਵੀ ਬਣਾਏ ਜਾਂਦੇ ਹਨ ਅਤੇ ਗੰਨੇ ਦਾ ਰਸ ਵੀ ਕੱਢਿਆ ਜਾਂਦਾ ਹੈ ਅਤੇ ਗੰਨੇ ਤੋਂ ਚੀਨੀ ਬਣਾਈ ਜਾਂਦੀ ਹੈ ਅਤੇ ਗੰਨੇ ਦਾ ਗੁੜ ਵੀ ਬਣਾਇਆ ਜਾਂਦਾ ਅਤੇ ਜਿਹੜੀ ਕਣਕ ਹੈ ਉਹ ਉਹਨੂੰ ਪੀਸ ਕੇ ਕਣਕ ਦੇ ਦਾਣਿਆਂ ਨੂੰ ਦਲੀਆ ਵੀ ਬਣਾਇਆ ਜਾਂਦਾ ਹੈ ਅਤੇ ਜੋ ਕਿ ਅਸੀਂ ਖਾਣ ਵਿੱਚ ਬਹੁਤ ਚੰਗਾ ਹੁੰਦਾ ਹੈ ਅਤੇ ਜੋ ਦਾਲਾਂ ਹਨ ਉਹਨਾਂ ਨੂੰ ਅਸੀਂ ਘਰ ਵਿੱਚ ਬਣਾਉਂਦੇ ਹਾਂ ਅਤੇ ਅਤੇ ਜੋ ਵੀ ਸਾਡੇ ਖੇਤਰ ਵਿੱਚ ਸਬਜ਼ੀਆਂ ਬੀਜੀਆਂ ਜਾਂਦੀਆਂ ਹਨ ਅਤੇ ਉਹ ਕਣਕ ਅਤੇ ਚੌਲ ਜ਼ਿਆਦਾ ਉਹਨਾਂ ਦੀ ਮੰਗ ਹੈ ਅਤੇ ਜਿਸ ਕਰਕੇ ਇਹ ਇਹ ਸਭ ਤੋਂ ਜ਼ਿਆਦਾ ਬੀਜੀਆਂ ਜਾਂਦੀਆਂ ਹਨ ਅਤੇ ਸਾਡੇ ਲਈ ਇਹ ਬਹੁਤ ਲਾਭਦਾਇਕ ਹਨ